ਭੰਗੜਾ ਅਰੋਬਿਕਸ ਲਈ ਕੋਈ ਖਾਸ ਮੁਕਾਬਲੇ ਨਹੀਂ ਹੈ ਲੋਕ ਆਪਣਾ ਮਨੋਰੰ ਭੰਗੜਾ ਲੋਕ ਭੰਗੜਾ ਆਪਣਾ ਮਨੋਰੰਜਨ ਲਈ ਕਰਦੇ ਹਨ ਜਿੱਦਾਂ ਕਿ ਉਹਨਾਂ ਦੀ ਸਿਹਤ ਬਣੀ ਰਹੇ ਅਤੇ ਉਹ ਆਪਣਾ ਮਨੋਰੰਜਨ ਕਰਦੇ ਰਹਿਣ ਇਸ ਲਈ ਭੰਗੜਾ ਕੀਤਾ ਜਾਂਦਾ ਹੈ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਕਿ ਭੰਗੜਾ ਕੋਈ ਔਖਾ ਭੰਗੜਾ ਹਰੇਕ ਵਿਅਕਤੀ ਵਧੀਆ ਤਰੀਕੇ ਨਾਲ ਕਰਦਾ ਹੈ ਅਤੇ ਆਪਣੇ ਮਨੋਰੰਜਨ ਲਈ ਕਰਦਾ ਹੈ ਜਿਸ ਨਾਲ ਉਹਨਾਂ ਦਾ ਮਨ ਅਤੇ ਸਿਹਤ ਵਧੀਆ ਤਰੀਕੇ ਨਾਲ ਬਣੀ ਰਹੇ ਅਤੇ ਭੰਗੜਾ ਕਿ ਕਿਸੇ ਵੀ ਸਮੇਂ ਕਿਤੇ ਵੀ ਕੀਤਾ ਜਾ ਸਕਦਾ ਹੈ ਲੋਕ ਆਪਣਾ ਭੰਗੜਾ ਕਿਸੇ ਵੀ ਵਿਆਹ ਸ਼ਾਦੀਆਂ ਵਿੱਚ ਇੰਟਰਟੇਂਨਮੇਂਟ ਵਾਸਤੇ ਕਰਦੇ ਹਨ ਭੰਗੜਾ ਹਰੇਕ ਵਿਅਕਤੀ ਲਈ ਬਹੁਤ ਹੀ ਵਧੀਆ ਹੁੰਦਾ ਹੈ ਸਭ ਨੂੰ ਵਧੀਆ ਲੱਗਦਾ ਹੈ ਇਸ ਲਈ ਭੰਗੜਾ ਜ਼ਰੂਰੀ ਹੈ ਅਰੋਬਿਕਸ ਲਈ ਕੋਈ ਖਾਸ ਮੁਕਾਬਲੇ ਨਹੀਂ ਰੱਖਦਾ ਅਤੇ ਭੰਗੜਾ ਵਿਅਕਤੀ ਆਪਣੇ ਇੰਟਰਟੇਂਨਮੇਂਟ ਲਈ ਵੀ ਕਰਦਾ ਹੈ ਇਸ ਲਈ ਭੰਗੜਾ ਕੋਈ ਖਾਸ ਮੁਕਾਬਲੇ ਨਹੀਂ ਰੱਖਦਾ ਕਿਸੇ ਦੇ ਭੰਗੜਾ ਹਰੇਕ ਵਿਅਕਤੀ ਲਈ ਬਹੁਤ ਹੀ ਵਧੀਆ ਹੈ